ਹਾਂਜੀ ਮੈਂ ਦਸਵੀਂ ਪੜ੍ਹੀ ਹਾਂ ਸਾਡੇ ਡੈਡੀ ਬਹੁਤ ਗਰੀਬ ਸੀ ਤੋ ਅਤੇ ਸਾਨੂੰ ਪੜ੍ਹਾ ਨਹੀਂ ਸਕੇ ਹੈ ਨਾ ਉਹ ਮਜ਼ਦੂਰੀ ਕਰਦੇ ਸੀ ਅਤੇ ਅਸੀਂ ਨਾ ਮਤਲਬ ਕਿ ਪੰਜ ਭੈ ਭੈਣਾਂ ਸਨ ਫਿਰ ਵਾਰੀ ਵਾਰੀ ਸਾਰੇ ਦੇ ਵਿਆਹ ਵੀ ਕਰਨੇ ਅੱਜ ਕੱਲ੍ਹ ਇੰਨੀਂ ਮਹਿੰਗਾਈ ਹੈ ਮੈਂ ਸਭ ਤੋਂ ਵੱਡੀ ਆ ਮੇਰੇ ਤੋਂ ਚਾਰ ਛੋਟੀ ਭੈਣ ਹੈ ਉਹ ਦੋ ਤਾਂ ਮੇਰੀ ਭੈਣ ਮਤਲਬ ਕਿ ਪੜ੍ਹ ਰਹੀ ਹੈ ਬਟ ਮੈਂ ਥੋੜ੍ਹਾ ਕ ਘੱਟ ਪੜ੍ਹੀ ਆ ਕਿਉਂਕਿ ਇੰਨੀ ਜ਼ਿਆਦਾ ਪਾਪਾ ਦੀ ਮੇਰੀ ਸੈਲਰੀ ਸੀ ਨਹੀਂ ਅਤੇ ਮੈਂ ਆਪਣੇ ਐਧਰ ਉੱਧਰ ਕੰਮ 'ਤੇ ਲੱਗ ਗਈ ਦੁਕਾਨ ਉੱਤੇ ਜੋਬ ਕਰਨ ਲੱਗੀ ਹੈ ਨਾ ਵੀ ਘਰ ਗਰ ਦਾ ਖ਼ਰਚਾ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਇੰਨੇ ਭਾਈ ਭੈਣ ਪਾਪਾ ਅਕੇਲੇ ਕੁਝ ਕਰ ਨਹੀਂ ਸਕਦੇ ਸੀ ਮੇਰਾ ਕੋਈ ਭਰਾ ਵੀ ਨੀ ਹੈ ਤਾਂ ਫਿਰ ਮੈਂ ਆਪਣੇ ਡੈਡੀ ਦੇ ਨਾਲ਼ ਨਾ ਕੰਮ ਵਿੱਚ ਹੱਥ ਵਟਾਕੇ ਹੁਣ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸੀ ਇਸ ਕਰਕੇ ਮੈਂ ਜ਼ਿਆਦਾ ਪੜ੍ਹ ਨਹੀਂ ਸਕੀ ਮੈਂ ਸਿਰਫ਼ ਦਸਵੀਂ ਹੀ ਪੜ੍ਹਕੇ ਹੋ ਛੱਡਤਾ